ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਆਪਣੀ ਸੈਮਸੰਗ ਦੀ ਸਮਾਰਟ ਵੋਚ ਲਿੱਤੀ ਹੈ ਜੋ ਕਿ ਬਹੁਤ ਹੀ ਵਧੀਆ ਹੈ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਟੈਕਨੋਲੋਜੀ ਆ ਗਈ ਪਹਿਲੇ ਤੌਰ 'ਤੇ ਕੁਛ ਵੀ ਟੈਕਨੋਲੋਜੀ ਸਾਡੇ ਦੇਸ਼ ਵਿੱਚ ਨਹੀਂ ਸੀ ਪਹਿਲੇ ਜਿਵੇਂ ਕਿ ਹੁਣ ਸਾਡੇ ਥੋੜ੍ਹੇ ਸਮੇਂ ਪਹਿਲੇ ਪਹਿਲਾਂ ਬਟਨਾ ਆਲਾ ਫੋਨ ਆਇਆ ਫਿਰ ਉਸ ਤੋਂ ਬਾਅਦ ਹੀ ਇਹ ਟੱਚ ਫੋਨ ਚਾਲੂ ਹੋ ਗਏ ਮੈਂ ਜਦੋਂ ਦਸਵੀਂ ਵਿੱਚ ਸੀ ਤਾਂ ਉਦੋਂ ਮੈਨੂੰ ਹਜੇ ਮੇਰੇ ਕੋਲ ਕੋਈ ਵੀ ਫੋਨ ਵਗੈਰਾ ਨਹੀਂ ਸੀ ਜਦੋਂ ਮੈਂ ਪਲੱਸ ਟੂ ਕਲਾਸ ਵਿੱਚ ਹੋਇਆ ਤਾਂ ਮੇਰੇ ਘਰਦਿਆਂ ਨੇ ਮੈਨੂੰ ਫੋਨ ਲੈ ਕੇ ਦਿੱਤਾ ਅਤੇ ਮੈਂ ਫੋਨ ਫੋਨ ਵਗੈਰਾ ਚਲਾਇਆ ਫਿਰ ਉਸ ਤੋਂ ਬਾਅਦ ਹੀ ਹੁਣ ਮੈਨੂੰ ਮੇਰੇ ਘਰਦਿਆਂ ਨੇ ਸੈਮਸੰਗ ਦੀ ਵੋਚ ਅਲਟਰਾ ਵੋਚ ਲੈ ਕੇ ਦਿੱਤੀ ਹੈ ਜੋ ਕਿ ਬਹੁਤ ਹੀ ਵਧੀਆ ਹੈ ਅਤੇ ਉਸ ਤੋਂ ਹਰ ਚੀਜ਼ ਹੋ ਜਾਂਦੀ ਹੈ ਜਿਵੇਂ ਕਿ ਮੈਂ ਆਪਣਾ ਫੋਨ ਵੀ ਉਸ ਸੈਮਸੰਗ ਵੋਚ ਨਾਲ ਅਟੈਚ ਕਰ ਲੈਂਦਾ ਹਾਂ ਅਤੇ ਉਸ ਵੋਚ ਨਾਲ ਹੀ ਮੈਂ ਗਾਣੇ ਵਗੈਰਾ ਵੀ ਸੁਣਦਾ ਹਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਵੇਂ ਕਿ ਉਹ ਫੋਟੋਗ੍ਰਾਫੀ ਉਸ ਵੋਚ ਤੋਂ ਹੀ ਉਹ ਜਾਂਦੀ ਹੈ ਅਤੇ ਫੋਨ ਵਗੈਰਾ ਵੀ ਉਸ ਵੋਚ ਤੋਂ ਹੀ ਮੈਂ ਕਰ ਲੈਂਦਾ ਹਾਂ ਮੈਂ ਇਹ ਵੋਚ ਮੈਂ ਇਹ ਵੋਚ ਬਹੁਤ ਹੀ ਵਧੀਆ ਥਾਂ ਤੋਂ ਲਿੱਤੀ ਹੈ ਜੋ ਕਿ ਸਾਡੇ ਇੱਕ ਲਾਗੇ ਵਿੱਕੀ ਟੈਲੀਕਮ ਹੈ ਮੈਂ ਉਸ ਤੋਂ ਇਹ ਵੋਚ ਲਿੱਤੀ ਹੈ ਪਹਿਲੇ ਪਹਿਲੇ ਜਦੋਂ ਮੈਂ ਇਹ ਵੋਚ ਲਿੱਤੀ ਸੀ ਮੈਨੂੰ ਇਸ ਦੇ ਸ਼ਿਸ਼ਟਮ ਸਮਝ ਨਹੀਂ ਸੀ ਆਏ ਫਿਰ ਮੈਂ ਹੌਲੀ ਹੌਲੀ ਇਹ ਵੋਚ ਨੂੰ ਚਲਾਉਣਾ ਸਿੱਖਿਆ ਅਤੇ ਮੈਨੂੰ ਇਹ ਵੋਚ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਲੱਗਾ ਇਸ ਕਰਕੇ ਸਾ ਇਸ ਕਰਕੇ ਇਹ ਵੋਚ ਬਹੁਤ ਹੀ ਵਧੀਆ ਲੱਗੀ ਅਤੇ ਮੈਨੂੰ ਇਹ ਵੋਚ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਲੱਗਾ ਅਤੇ ਮੈਂ ਇਸ ਵੋਚ ਨੂੰ ਹਰ ਰੋਜ਼ ਆਪਣੇ ਨਾਲ ਹਰ ਟਾਈਮ ਜਦੋਂ ਵੀ ਮੈਂ ਕਿਤੇ ਘੁੰਮਣ ਵਗੈਰਾ ਜਾਂਦਾ ਹਾਂ ਤਾਂ ਮੈਂ ਇਹੀ ਵੋਚ ਨੂੰ ਆਪਣੇ ਨਾਲ ਲਗਾ ਕੇ ਹੀ ਜਾਂਦਾ ਹਾਂ ਤਾਂ ਕਿ ਜੋ ਕਿ ਮੈਨੂੰ ਜਿਹੜਾ ਵੀ ਮੈਂ ਰਾਹ ਵਿੱਚ ਬਾਈਕ ਵਗੈਰਾ ਵੀ ਚਲਾਉਂਦਾ ਹਾਂ ਕਿਸੇ ਤਰ੍ਹਾਂ ਮੇਰੇ ਕੋਲ ਕਦੀ ਕਦੀ ਜੇਬ ਵਿੱਚ ਫੋਨ ਵੀ ਨਹੀਂ ਨਿਕਾਲਿਆ ਜਾਂਦਾ ਜਿਸ ਕਰਕੇ ਮੈਨੂੰ ਨਹੀਂ ਪਤਾ ਲੱਗਦਾ ਇਸ ਕਰਕੇ ਮੈਂ ਇਹ ਵੋਚ ਆਪਣੇ ਹਮੇਸ਼ਾ ਬੰਨ ਕੇ ਹੀ ਰੱਖਦਾ ਹਾਂ ਅਤੇ ਮੈਨੂੰ ਤਾਂ ਕਿ ਜੋ ਕਿ ਜਦੋਂ ਵੀ ਮੈਨੂੰ ਫੋਨ ਆਉਂਦਾ ਹੈ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਇਸ ਕਰਕੇ ਮੈਂ ਕਦੀ ਵੀ ਇਹ ਵੋਚ ਦੀ ਬੁਰਿਆਈ ਨਹੀਂ ਕਰਾਂਗਾ